ਚੌਵੀ ਜੂਨ ਉੱਨੀ ਸੌ ਇਕਹੱਤਰ ਤੇਈ ਜੁਲਾਈ ਉੱਨੀ ਸੌ ਅਠਾਸੀ ਪੰਜ ਜਨਵਰੀ ਦੋ ਹਜ਼ਾਰ ਨੌ ਇੱਕੀ ਅਪ੍ਰੈਲ ਉੱਨੀ ਸੌ ਇਕਿਆਸੀ ਸੱਤ ਮਈ ਦੋ ਹਜ਼ਾਰ